ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਖੇਡ ਦਾ ਬਹੁਤ ਅੰਤਰ ਹੈ ਪੇਂਡੂ ਖੇਡਾਂ ਬਹੁਤ ਵਧੀਆ ਹੁੰਦੀਆਂ ਸਨ ਜੋ ਕਿ ਅੱਜ ਕੱਲ੍ਹ ਖਤਮ ਹੋ ਗਈਆਂ ਹਨ ਜਿੱਦਾਂ ਕਿ ਪੇਂਡੂ ਗੇਮਾਂ ਜਦੋਂ ਪਿੰਡ ਵਿੱਚ ਕਬੱਡੀ ਖੇਡਣੀ ਟੂਰਨਾਮੈਂਟ ਹੋਣੇ ਹ ਗੁੱਲੀ ਡੰਡਾ ਖੇਲਣਾ ਜੋ ਵੀ ਸ਼ਹਿਰ ਵਿੱਚ ਅੱਜ ਕੱਲ੍ਹ ਸ਼ਹਿਰੀ ਖੇ ਖੇਡਾਂ ਵਿੱਚ ਇਹੋ ਜਿਹਾ ਕੁਛ ਵੀ ਨਹੀਂ ਰਹਿ ਗਿਆ ਬੱਚੇ ਅਤੇ ਬਸ ਅੱਜ ਕੱਲ੍ਹ ਜਿੱਦਾਂ ਕ੍ਰਿਕਟ ਵੀ ਖੇਲਣਾ ਹੋਵੇ ਤਾਂ ਫੋਨ 'ਤੇ ਖੇਲ ਲੈਂਦੇ ਹਨ ਲੂਡੋ ਵਗੈਰਾ ਸਾਰਾ ਕੁਛ ਸ਼ਹਿਰੀ ਖੇਡਾਂ ਬੱਚੇ ਫੋਨ 'ਤੇ ਹੀ ਖੇਡਦੇ ਹਨ ਸ਼ਹਿਰ ਪਿੰਡ ਪੇਂਡੂ ਜਦੋਂ ਹੁੰਦਾ ਸੀ ਪੇਂਡੂ ਖੇਡਾਂ ਵਿੱਚੋਂ ਬਹੁਤ ਜ਼ਿਆਦਾ ਵਧੀਆ ਲੱਗਦਾ ਸੀ ਮੈਦਾਨ 'ਚ ਜਾ ਕੇ ਮੈਂ ਕ੍ਰਿਕਟ ਖੇਲਣਾ ਗੁੱਲੀ ਡੰਡਾ ਖੇਲਣਾ ਕਬੱਡੀ ਖੇਲਣਾ ਸੈਰ ਸਪਾਟਾ ਕਰਨਾ ਖੁੱਲ੍ਹੀਆਂ ਥਾਵਾਂ 'ਤੇ ਆਉਣਾ ਜਾਣਾ ਵਾਤਾਵਰਨ ਵਧੀਆ ਹੁੰਦਾ ਸੀ ਸ਼ਹਿਰੀ ਖੇਡਾਂ ਵਿੱਚ ਤਾਂ ਕੁਝ ਵੀ ਨਹੀਂ ਰਹਿ ਗਿਆ ਘਰ ਬੈਠੇ ਬੈਠੇ ਹੀ ਫੋਨ 'ਤੇ ਸਾਰੀਆਂ ਗੇਮਾਂ ਖੇਡੀ ਜਾ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੇਂਡੂ ਖੇਡਾਂ ਕੀ ਹੁੰਦੀਆਂ ਹਨ ਕਿੱਦਾਂ ਹੁੰਦੀਆਂ ਹਨ ਜੋ ਕਿ ਬਹੁਤ ਵਧੀਆ ਸੀ ਉਹੀ ਖੇਡਾਂ ਦਾ ਅੱਜ ਕੱਲ੍ਹ ਕੋਈ ਮਹੱਤਵ ਹੀ ਨਹੀਂ ਰਹਿ ਗਿਆ ਸ਼ਹਿਰੀ ਖੇਡਾਂ ਨੇ ਸਾਰਾ ਕੁਝ ਪੇਂਡੂ ਖੇਡਾਂ ਦਾ ਮਹੱਤਵ ਖਤਮ ਕਰ ਦਿੱਤਾ ਹੈ ਪਰ ਉਹ ਖੇਡਾਂ ਪੁਰਾਣੇ ਜ਼ਮਾਨੇ ਦੀਆਂ ਬਹੁਤ ਵਧੀਆ ਖੇਡਾਂ ਸੀ ਪੇਂਡੂ ਖੇਡਾਂ ਉਹ ਤੁਸੀਂ ਜੋ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਕੁਛ ਵੀ ਇਸ ਬਾਰੇ ਨਹੀਂ ਪਤਾ ਹੈਗਾ